ਹਾਂਜੀ ਮੈਂ ਡਾਂਸ ਮੁਕਾਬਲੇ ਦੇ ਵਿੱਚ ਬਹੁਤ ਵਾਰੀ ਹਿੱਸਾ ਲਿਆ ਹੋਇਆ ਹੈ ਜਿਵੇਂ ਕਿ ਜੋ ਸਾਡੇ ਪੰਜਾਬ ਦਾ ਪਾਰੰਪਰਿਕ ਜੋ ਸਾਡਾ ਲੋਕ ਨਾਚ ਹੈ ਜਿਵੇਂ ਕਿ ਗਿੱਧਾ ਮੈਂ ਉਸ ਦੇ ਵਿੱਚ ਭਾਗ ਲਿਆ ਸੀ ਜਿਸ ਦਾ ਮੈਨੂੰ ਭਾਗ ਲੈ ਕੇ ਮੈਂ ਬਹੁਤ ਕੁਛ ਸਿੱਖਿਆ ਲੋਕ ਨਾਚ ਜੋ ਸਾਡੇ ਪੰਜਾਬ ਦਾ ਲੋਕ ਨਾਚ ਹੈ ਉਹਦੇ ਬਾਰੇ ਮੈਨੂੰ ਬਹੁਤ ਡੂੰਘੀ ਜਾਣਕਾਰੀ ਮਿਲੀ ਜਿਵੇਂ ਕਿ ਇਸ ਦੇ ਵਿੱਚ ਬੋਲੀਆਂ ਪਾਈਆਂ ਜਾਂਦੀਆਂ ਹਨ ਗਿ ਜੋ ਗਿੱਧਾ ਹੈ ਜੋ ਗਿੱਧਾ ਮੁਟਿਆਰਾਂ ਦਾ ਹੀ ਇੱਕ ਲੋਕ ਨਾਚ ਹੈ ਜਿਸ ਵਿੱਚ ਮੁਟਿਆਰਾਂ ਵੱਖ ਵੱਖ ਬੋਲੀਆਂ ਪਾ ਕੇ ਆਪਦੀ ਖੁਸ਼ੀ ਦਾ ਇਜ਼ਹਾਰ ਕਰਦੀਆਂ ਹਨ ਅਤੇ ਮੈਂ ਇਸ ਵਿੱਚ ਜੋ ਸਾਡੇ ਇੱਥੇ ਯੂਥ ਫੈਸਟੀਵਲ ਹੁੰਦੇ ਹੈ ਉਹਦੇ ਵਿੱਚ ਮੈਂ ਗਿੱਧੇ ਦੇ ਵਿੱਚ ਭਾਗ ਲਿਆ ਸੀ ਜੋ ਕਿ ਮੇਰਾ ਬਹੁਤ ਵਧੀਆ ਇੱਕ ਤਜਰਬਾ ਰਿਹਾ ਸੀ ਜਿਸ ਵਿੱਚ ਮੈਂ ਬਹੁਤ ਕੁਛ ਸਿੱਖਿਆ ਸੀ ਪੰਜਾਬੀ ਲੋਕ ਨਾਚ ਬਾਰੇ ਅਤੇ ਮੈਨੂੰ ਬਹੁਤ ਕੁਛ ਇਹਦੇ ਤੋਂ ਸਿੱਖਣ ਨੂੰ ਮਿਲਿਆ ਇਹਦੇ ਵਿੱਚ ਵੱਖੋ ਵੱਖਰੀਆਂ ਬੋਲੀਆਂ ਵੱਖ ਵੱਖ ਮੌਕਿਆਂ 'ਤੇ ਵੱਖ ਵੱਖ ਬੋਲੀਆਂ ਪਾਈਆਂ ਜਾਂਦੀਆਂ ਹਨ ਇਹਦੇ ਬਾਰੇ ਮੈਨੂੰ ਸਭ ਕੁਛ ਜਾਣਨ ਦਾ ਮੌਕਾ ਮਿਲਿਆ ਸੀ ਅਤੇ ਮੈਂ ਬਹੁਤ ਹੀ ਆਪਦਾ ਆਪਦਾ ਮਨੋਰੰਜਨ ਕੀਤਾ ਸੀ ਇਸ ਦੇ ਵਿੱਚ